ਹਾਂਜੀ ਭੰਗੜੇ 'ਚ ਅਸੀਂ ਐਰੋਬਿਕਸ ਵੀ ਕਰ ਸਕਦੇ ਹਾਂ ਅਤੇ ਕੋਰੀਓਗ੍ਰਾਫਰ ਇੱਦਾਂ ਬਣ ਸਕਦੇ ਹਾਂ ਕਿ ਪਹਿਲੇ ਪਹਿਲੇ ਤਾਂ ਲੋਕ ਪੰਜਾਬ 'ਚ ਬਹੁਤ ਟਰੈਂਡ ਸੀ ਭੰਗੜੇ ਦਾ ਤਾਂ ਤੁਸੀਂ ਢੋਲਾਂ ਨਾਲ ਹੀ ਨੱਚਦੇ ਸੀਗੇ ਲੋਕ ਢੋਲ ਲਿਆਉਂਦੇ ਸੀ ਅਤੇ ਢੋਲਾਂ ਨਾਲ ਨੱਚਦੇ ਸੀਗੇ ਅਤੇ ਪਰ ਅੱਜ ਕੱਲ੍ਹ ਗਾਣੇ ਬਹੁਤ ਅੱਛੇ ਆ ਗਏ ਪੰਜਾਬੀ ਪੰਜਾਬ ਦੇ ਪੰਜਾਬੀ ਗਾਣਿਆਂ 'ਚ ਤੁਸੀਂ ਦੇਖ ਦੇਖ ਕੇ ਟੀ ਵੀ ਨੂੰ ਦੇਖ ਦੇਖ ਕੇ ਯੂਟੀਊਬਸ ਦੇਖ ਦੇਖ ਕੇ ਤੁਸੀਂ ਕਾਫੀ ਕੁਝ ਸਿੱਖ ਗਏ ਉਹਨਾਂ ਤੋਂ ਅਤੇ ਅੱਜ ਕੱਲ੍ਹ ਤਾਂ ਵਿਆਹਾਂ ਸ਼ਾਦੀਆਂ 'ਚ ਲੋਕ ਕੋਰੋਗ੍ਰਾ ਕੋਰਿਓਗ੍ਰਾਫਰ ਵੀ ਹਾਇਰ ਕਰਨ ਲੱਗ ਪਏ ਆ ਅਤੇ ਉਹ ਵੀ ਲੋਕਾਂ ਨੂੰ ਅੱਛੇ ਸਟੈੱਪ ਸਿਖਾ ਦਿੰਦੇ ਆ ਅਤੇ ਉੱਥੋਂ ਤੁਸੀਂ ਤੁਹਾਨੂੰ ਇੱਕ ਦੋ ਸਿੱਖਣ ਨਾਲ ਤੁਸੀਂ ਚਾਰ ਪੰਜ ਜਾਂ ਹੋਰ ਆਪਣੇ ਕੋਲ ਸਿੱਖ ਲੈਂਦੇ ਤੁਹਾਨੂੰ ਪੈਰ ਮਾਰਨੇ ਆ ਜਾਂਦੇ ਜਦੋਂ ਪੈਰ ਮਾਰਨੇ ਆਉਣ ਤਾਂ ਤੁਸੀਂ ਤਰਜ਼ 'ਤੇ ਢੋਲ 'ਤੇ ਤੁਸੀਂ ਤੁਹਾਡੇ ਆਪਣੇ ਆਪ ਪੈਰ ਚੱਲ ਪੈਂਦੇ ਨੇ ਮੇਰੀ ਇੱਕ ਇੱਕ ਵਾਰੀ ਮੇਰੀ ਕਜ਼ਨ ਦੀ ਮੈਰਿਜ ਸੀਗੀ ਪਿੱਛੇ ਜਿਹੇ ਤਿੰਨ ਚਾਰ ਮਹੀਨੇ ਪਹਿਲੇ ਉੱਥੇ ਅਸੀਂ ਇੱਕ ਕੋਰਿਓਗ੍ਰਾਫਰ ਹ ਹਾਇਰ ਕੀਤਾ ਹੋਇਆ ਸੀਗਾ ਉਹਨੂੰ ਬੁਲਾਇਆ ਸੀਗਾ ਉਹਨੇ ਸਾਨੂੰ ਪੂਰੇ ਦੋ ਤਿੰਨ ਗਾਣਿਆਂ 'ਤੇ ਪੂਰੇ ਸਟੈਪ ਸਿਖਾਏ ਉੱਥੋਂ ਅਸੀਂ ਬਿਲਕੁਲ ਟ੍ਰੇਂਡ ਹੋ ਗਏ ਤਾਂ ਕਾਫੀ ਅੱਛਾ ਅਸੀਂ ਪਰਫੋਰਮੈਂਸ ਕੀਤੀ ਸਾਰਿਆਂ ਨੇ ਬਹੁਤ ਮਤਲਬ ਵਧਾਈ ਦਿੱਤੀ ਕਿ ਤੁਸੀਂ ਬਹੁਤ ਅੱਛਾ ਕੀਤਾ ਬਹੁਤ ਪ੍ਰੇਮ ਸਾਡੀ ਪ੍ਰਸ਼ੰਸਾ ਕੀਤੀ ਜਿਹਨੂੰ ਦੇਖ ਕੇ ਸਾਡਾ ਹੌਸਲਾ ਹੋਰ ਵੱਧ ਗਿਆ ਅਤੇ ਅਸੀਂ ਮਤਲਬ ਕਾਫੀ ਹੋਰ ਜ਼ਿਆਦਾ ਸਿੱਖਣਾ ਦ ਦਿਲ ਕਰਦਾ ਵੀ ਹੋਰ ਅੱਗੇ ਸਿੱਖੀਏ ਕਾਫੀ ਆ ਵੀ ਗਿਆ ਔਰ ਭੰਗੜੇ ਨਾਲ ਵਿਆਹਾਂ ਦੀ ਸ਼ਾਨ ਵੀ ਵੱਧ ਜਾਂਦੀ ਹੈ ਤੁਸੀਂ ਨੱਚ ਟੱਪ ਜਦੋਂ ਨੱਚਦੇ ਟੱਪਦੇ ਹੋ ਤਾਂ ਲੋਕਾਂ ਦਾ ਦਿਲ ਵੀ ਲੱਗਦਾ ਤਾਂ ਇੱਦਾਂ ਲੱਗਦਾ ਕਿ ਵਾਕਈ ਕੋਈ ਫੰਕਸ਼ਨ ਘਰ 'ਚ ਚੱਲਦਾ ਪਿਆ ਵਿਆਹ ਵੁਆ ਚਲਦਾ ਪਿਆ ਤਾਂ ਉੱਥੋਂ ਉਸ ਕੋਰੀਓਗ੍ਰਾਫਰ ਤੋਂ ਮੈਂ ਬਹੁਤ ਕੁਝ ਸਿੱਖਿਆ ਉਹਨੇ ਕਾਫੀ ਮੈਨੂੰ ਵਧੀਆ ਵਧੀਆ ਸਟੈਪ ਸਿਖਾਏ ਤਾਂ ਹੁਣ ਮੈਂ ਮਤਲਬ ਹੋਰ ਲੋਕਾਂ ਨੂੰ ਵੀ ਅੱਗੋਂ ਸਿਖਾ ਸਕਦੀ ਹਾਂ ਔਰ ਸਿਖਾਉਂਦੀ ਵੀ ਹਾਂ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਹਾਂ ਕਿ ਮਤਲਬ ਇੱਦਾਂ ਇੱਦਾਂ ਆਪਣਾ ਅਸੀਂ ਫੰਕਸ਼ਨਾਂ 'ਤੇ ਇੰਜੋਏ ਕਰ ਸਕਦੇ ਹਾਂ